ਬਾਈਕਿੰਗ ਕਰਨ ਲੱਗੇ ਲੋਕਾਂ ਦਾ ਜਨੂੰਨ ਬਹੁਤ ਉੱਚਾ ਹੁੰਦਾ ਹੈ ਅਤੇ ਉਹ ਉਸ ਸਮੇਂ ਕਾਫ਼ੀ ਖੁਸ਼ ਅਤੇ ਆਰਾਮਦਾਇਕ ਹੁੰਦੇ ਹਨ ਜਿਵੇਂ ਜਿਵੇਂ ਹੋਰ ਬੋਡੀ ਨਰਮ ਅਤੇ ਨਿੱਘੀ ਹੁੰਦੀ ਹੈ ਉੱਦਾਂ ਉੱਦਾਂ ਬੋਡੀ ਆਪਾਂ ਉੱਦਾਂ ਉੱਦਾਂ ਜਿਹੜਾ ਪੈਦਲ ਬਾਈਕਿੰਗ ਕਰਨ ਦਾ ਜੋ ਔਖਾ ਸਮਾਂ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ ਜਿਵੇਂ ਜਿਵੇਂ ਅੱਗੇ ਚੱਲਦੇ ਹਨ ਓਦੇ ਓਵੇਂ ਮੈਡੀਟੇਸ਼ਨ ਵਰਗਾ ਮਹੌਲ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਜ ਸ ਸਮੇਂ ਅਤੇ ਕਿਲੋਮੀਟਰ ਦਾ ਕੁਝ ਹਿਸਾਬ ਨਹੀਂ ਰਹਿੰਦਾ ਕੇ ਕਿੰਨਾ ਬਚਿਆ ਅਤੇ ਕਿੰਨਾ ਰਹਿ ਗਿਆ ਇਹ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਕੁਛ ਦਿਨਾਂ ਦੀ ਬਾਈਕਿੰਗ ਕਰਕੇ ਘਰ ਲੋਟਦੇ ਹਾਂ ਅਤੇ ਲੋਟ ਕੇ ਅਸੀਂ ਅਰਾਮ ਕਰਦੇ ਹਾਂ